ਸਤਿ ਸ਼੍ਰੀ ਅਕਾਲ ਕੀ ਤੁਸੀਂ ਉਬਰ ਤੋਂ ਬੋਲ ਰਹੇ ਹੋ ਜੀ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦੀ ਸੀ ਕਿ ਮੈਂ ਤੁਹਾਡੀ ਕੈਬ ਬੁੱਕ ਕਰਨੀ ਹੈ ਮੇਰੀ ਮਾਤਾ ਜੀ ਜੋ ਹਨ ਉਹ ਚੰਡੀਗੜ੍ਹ ਵਿੱਚ ਨੌਕਰੀ ਕਰਦੇ ਸਨ ਬਟ ਹੁਣ ਜੋ ਉਹ ਨੇ ਉਹ ਰਿਟਾਇਰ ਹੋ ਚੁੱਕੇ ਹਨ ਤਾਂ ਉਹ ਸਾਡੇ ਜੱਦੀ ਪਿੰਡ ਜੋ ਕਿ ਮੰਜੌਲੀ ਘਨੌਰ ਵਿਖੇ ਵੱਸਦਾ ਹੈ ਜ਼ਿਲ੍ਹਾ ਪਟਿਆਲਾ ਵਾਪਿਸ ਆਉਣਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਕੈਬ ਬੁੱਕ ਕਰ ਸਕਦੀ ਹਾਂ ਜਿਹੜਾ ਸਾਡਾ ਘਰ ਹੈ ਉਹ ਮੰਜੋਲੀ ਪਿੰਡ ਵਿੱਚ ਇੱਕ ਖੇਤਾਂ ਦੇ ਵਿਚਾਲੇ ਹੈ ਜਦੋਂ ਹੀ ਤੁਸੀਂ ਪਿੰਡ ਵਿੱਚ ਵੜੋਂਗੇ ਤਾਂ ਸਾਹਮਣੇ ਹੀ ਇੱਕ ਸਰਕਾਰੀ ਸਕੂਲ ਹੈ ਸਰਕਾਰੀ ਸਕੂਲ ਤੋਂ ਸਿੱਧਾ ਇੱਕ ਕੱਚਾ ਰਾਸਤਾ ਸਾਹਮਣੇ ਇੱਕ ਇਕੱਲੇ ਘਰ ਦੇ ਇੱਕ ਖੇਤਾਂ ਵਿੱਚ ਜਾ ਕੇ ਇਕੱਲਾ ਹੀ ਘਰ ਹੈ ਉਹ ਰਸਤਾ ਸਿੱਧਾ ਉੱਥੇ ਹੀ ਜਾਂਦਾ ਹੈ ਅਤੇ ਤੁਸੀਂ ਸਕੂਲ ਤੋਂ ਸਿੱਧਾ ਸਿੱਧਾ ਜਾਣਾ ਹੈ ਅਤੇ ਮੇਰੀ ਮਾਤਾ ਜੀ ਦੀ ਜਾਣਕਾਰੀ ਮੈਂ ਤੁਹਾਨੂੰ ਭੇਜ ਦੇਵਾਂਗੀ ਅਤੇ ਮੈਂ ਤੁਹਾਡੇ ਨਾਲ ਇਹ ਵੀ ਜ਼ਿਕਰ ਕਰਨਾ ਸੀ ਕਿ ਤੁਸੀਂ ਇਹ ਚੰਡੀਗੜ੍ਹ ਤੋਂ ਲੈ ਕੇ ਸਾਡੇ ਜੱਦੀ ਪਿੰਡ ਤੱਕ ਕੀ ਕੀਮਤ ਲਵੋਂਗੇ ਤਾਂ ਕਿਰਪਾ ਕਰਕੇ ਮੈਨੂੰ ਇਸ ਚੀਜ਼ ਦੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ